ਪੰਜ ਅਗਸਤ ਉੱਨੀ ਸੌ ਬਿਆਸੀ ਸੱਤ ਮਈ ਉੱਨੀ ਸੌ ਉਨਾਸੀ ਤੇਈ ਜੂਨ ਉੱਨੀ ਸੌ ਤ੍ਰਿਆਨਵੇਂ ਸੱਤ ਦਸੰਬਰ ਉੱਨੀ ਸੌ ਸਤਾਨਵੇਂ ਪੰਦਰ੍ਹਾਂ ਦਸੰਬਰ ਦੋ ਹਜ਼ਾਰ ਦਸ